ਆਖਰੀ ਕਿਤਾਬ ਜਿਹੜੀ ਮੈਂ ਪੜ੍ਹ ਰਹੀ ਸੀ ਹੁਣੇ ਅਸੀਂ ਪਿੱਛੇ ਜੇ ਉਹ ਸੀ ਬਾਬਿਲ ਇਹ ਕਿਤਾਬ ਆਰ ਐੱਫ ਕੋਂਗ ਨੇ ਲਿਖੀ ਹੈ ਅਤੇ ਇਹਨੇ ਇੱਕ ਮੈਟਾ ਹਿਸਟਰੀ ਇੱਕ ਆਪਣੇ ਵੱਲੋਂ ਕਲਪਨਾ ਕਰਕੇ ਸਮੇਂ ਦੇ ਉਹ ਮੌੜ ਦੇ ਅੰਦਰ ਜਦੋਂ ਬਸਤੀਵਾਦ ਚੱਲ ਰਿਹਾ ਸੀ ਅਤੇ ਅੰਗਰੇਜ਼ਾਂ ਦਾ ਵੈਸਟ ਦਾ ਜਿਹੜਾ ਹੱਥ ਸੀ ਉਹ ਇੱਧਰ ਈਸਟ ਦੇ ਪੱਛਮ ਦਾ ਹੱਥ ਪੂਰਬ ਦੇ ਜਿਹੜੇ ਦੇਸ਼ਾਂ ਦੇ ਦੇਸ਼ਾਂ ਅਤੇ ਲੋਕਾਂ ਦੇ ਉੱਤੇ ਭਾਰੀ ਪੈ ਰਿਹਾ ਸੀ ਉਹ ਪਰਛਾਵਾਂ ਉਹਨੂੰ ਆਪਣੀ ਕਲਪਨਾ ਨਾਲ ਉਸ ਸਮੇਂ ਨੂੰ ਦੁਬਾੜਾ ਦੁਬਾਰਾ ਮੁੜ ਮੁੜ ਚਿਤਰਤ ਕੀਤਾ ਅਤੇ ਇੱਕ ਕਾਲਪਨਿਕ ਜਗਤ ਦੇ ਅੰਦਰ ਜਿਹਦੇ ਅੰਦਰ ਜਿਹੜੀ ਅਸਲੀਅਤ ਹੈ ਉਹ ਕੁਝ ਟੇਡੀ ਹੈ ਅਤੇ ਉਸ ਸਮੇਂ ਦੇ ਅੰਦਰ ਜਿਹੜੀ ਇੰਗਲੈਂਡ ਦੀ ਐਕਸਫੋਰਡ ਯੂਨੀਵਰਸਿਟੀ ਹੈ ਉਹ ਐਕਸਫੋਰਡ ਯੂਨੀਵਰਸਿਟੀ ਦੇ ਅੰਦਰ ਟਰਾਂਸਲੇਸ਼ਨ ਦਾ ਡਿਪਾਰਟਮੈਂਟ ਅਨੁਵਾਦ ਦਾ ਜਿਹੜਾ ਜਿਹੜਾ ਡਿਪਾਰਟਮੈਂਟ ਹੈ ਕੇਂਦਰ ਹੈ ਉਹਦੇ ਅੰਦਰ ਅਨੁਵਾਦ ਨੂੰ ਵਰਤ ਕੇ ਕਿੱਦਾਂ ਸ਼ਬਦਾਂ ਦੇ ਰਾਹੀਂ ਕੋਈ ਜਾਦੂ ਸ਼ਕਤੀ ਜਿਹੜੀ ਹੈ ਉਸ ਯੂਨੀਵਰਸ ਦੇ ਅੰਦਰ ਉਹ ਬ੍ਰਹਿਮੰਡ ਦੇ ਅੰਦਰ ਕਾਲਪਨਿਕ ਬ੍ਰਹਿਮੰਡ ਦੇ ਅੰਦਰ ਪੈਦਾ ਹੁੰਦੀ ਹੈ ਜਿਹਨੂੰ ਉਸ ਸਮੇਂ ਦੇ ਵਿਦ ਵਿਦਵਾਨ ਵਰਤਦੇ ਨੇ ਅਤੇ ਇੰਗਲੈਂਡ ਨੂੰ ਕਿਸ ਤਰ੍ਹਾਂ ਅਤੇ ਚੀਨ ਭਾਰਤ ਹੋਰ ਹੋਰ ਦੇਸ਼ਾਂ ਦੇ ਉੱਤੇ ਕਾਬਜ ਕਰਨ ਲਈ ਕਿੱਦਾਂ ਉਹ ਜਿਹੜੀ ਸ਼ਬਦਾਂ ਦੇ ਰਾਹੀਂ ਪੈਦਾ ਹੋ ਰਹੇ ਜਾਦੂ ਸ਼ਕਤੀ ਹੈ ਉਹਨੂੰ ਕਿੱਦਾਂ ਵਰਤਿਆ ਜਾਂਦਾ ਇਹ ਸਾਰੇ ਤੱਥਾਂ ਨੂੰ ਲੈ ਕੇ ਲਿਖਿਆ ਗਿਆ ਇਹ ਨਾਵਲ ਮੈਨੂੰ ਬੜਾ ਚੰਗਾ ਲੱਗਿਆ ਮੈਨੂੰ ਬੜਾ ਇਹਨੇ ਪ੍ਰਭਾਵਿਤ ਕੀਤਾ ਇਸ ਤਰੀਕੇ ਨਾਲ ਕਿ ਕਿੱਦਾਂ ਇੱਕ ਕਾਲਪਨਿਕ ਘੜੇ ਹੋਏ ਬ੍ਰਹਿਮੰਡ ਦੇ ਅੰਦਰ ਅਸੀਂ ਜਿਹੜਾ ਇਤਿਹਾਸ ਹੈ ਉਹਨੂੰ ਪੇਸ਼ ਕਰਕੇ ਜਿਹੜੀਆਂ ਹੁਣ ਤੱਕ ਸਿਰਫ ਭਾਵਨਾ ਦੇ ਅੰਦਰ ਮਹਿਸੂਸ ਕੀਤੇ ਕੀਤੀਆਂ ਗਈਆਂ ਹਿਸਟਰੀਆਂ ਹਨ ਮਹਿਸੂਸ ਕੀਤੇ ਗਏ ਇਤਿਹਾਸ ਹਨ ਜਿਹੜੀਆਂ ਨਾ ਸੁਣੀਆਂ ਗਈਆਂ ਅਤੇ ਨਾ ਬੋਲੀਆਂ ਹੋਈਆਂ ਹੁਣ ਤੱਕ ਆਵਾਜ਼ਾਂ ਹਨ ਜਿਹੜੀਆਂ ਮਿਟਾਈਆਂ ਗਈਆਂ ਆਵਾਜ਼ਾਂ ਹਨ ਉਹਨਾਂ ਨੂੰ ਕਿੱਦਾਂ ਮੁੜ ਸੁਰਜੀਤ ਕੀਤਾ ਜਾ ਸਕਦਾ ਉਹ ਇਤਿਹਾਸ ਜਿਹੜੇ ਕਦੇ ਸੁਣੇ ਨਹੀਂ ਜਾ ਸਕੇ ਜਾਂ ਜਿਨ੍ਹਾਂ ਨੂੰ ਕਦੇ ਖੜ੍ਹਾ ਨਹੀਂ ਹੋਣ ਦਿੱਤਾ ਗਿਆ ਜਿਹੜੇ ਪੱਛਮ ਦੇ ਪ੍ਰਭਾਵ ਹੇਠ ਲੁਕ ਛਿਪ ਕੇ ਜਾਂ ਦੱਬੇ ਕੁਚਲੇ ਰਹਿ ਗਏ ਉਹ ਇਤਿਹਾਸ ਨੂੰ ਕਲਪਨਾ ਦੇ ਰਾਹੀਂ ਕਿੱਦਾਂ ਨਵੇਂ ਤੌਰ 'ਤੇ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਸੱਚਾਈਆਂ ਨੂੰ ਪ੍ਰਗਟ ਕੀਤਾ ਜਾ ਸਕਦਾ ਉਹ ਮੈਨੂੰ ਬੜਾ ਹੀ ਚੰਗਾ ਲੱਗਿਆ